ਮੇਰੀ ਗੱਲ ਮੀਸ਼ੋ ਵਾਲਿਆ ਨਾਲ ਹੋ ਰਹੀ ਆ ਹਾਂਜੀ ਮੈਂ ਕੱਲ੍ਹ ਤੁਹਾਡੇ ਕੋਲ ਨਾ ਇੱਕ ਸੂਟ ਲਿਆ ਸੀ ਸੂਟ ਬਹੁਤ ਸੋਹਣਾ ਸੀ ਸ਼ੁਨੀਲ ਦਾ ਵੀ ਸੀ ਉਹਦੀਆਂ ਬੂਟੀਆਂ ਵੀ ਬਹੁਤ ਸੋਹਣੀਆਂ ਕਢਾਈ ਵੀ ਬਹੁਤ ਸੋਹਣੀ ਆ ਅਤੇ ਔਰ ਦੁਪੱਟਾ ਵੀ ਬਹੁਤ ਭਾਰੀ ਆ ਕ ਸੂਟ ਤਾਂ ਬਹੁਤ ਰੰਗ ਵੀ ਬਹੁਤ ਪਿਆਰਾ ਵਾ ਹਾਂਜੀ ਪੈਸੇ ਤਾਂ ਮੈਂ ਭੇਜਤੇ ਮੈਨੂੰ ਤਾਂ ਕਿਤੋਂ ਇੱਦਾਂ ਦਾ ਸੂਟ ਭਾਅ ਜੀ ਮਿਲਿਆਂ ਹੀ ਨਹੀਂ ਹੈਗਾ ਮੈਂ ਬਹੁਤ ਪਸੰਦ ਕੀਤਾ ਤੁਹਾਡਾ ਸੂਟ ਬਹੁਤ ਜ਼ਿਆਦਾ ਕਿਉਂਕਿ ਰੰਗ ਵੀ ਸੋਹਣਾ ਕਢਾਈ ਵੀ ਸੋਹਣੀ ਆ ਅਤੇ ਇਸ ਵਾਸਤੇ ਪੋਂਚਿਆਂ ਦੀ ਕਢਾਈ ਬਹੁਤ ਹੈਵੀ ਆ ਬਾਹਵਾਂ 'ਤੇ ਵੀ ਕਢਾਈ ਆ ਸੂਟ 'ਤੇ ਕਢਾਈ ਆ ਰੰਗ ਵੀ ਬੋ ਸੋਹਣਾ ਵਾ ਅਤੇ ਬੁਰ ਵੀ ਨਹੀਂ ਆਈ ਚੋੜਾ ਵੀ ਕਾਫ਼ੀ ਆ ਬ ਕਾਫ਼ੀ ਬਾਰ ਵੱਡਾ ਵਾ ਉਹਦਾ ਇਸ ਵਾਸਤੇ ਇਹੋ ਜਿਹਾ ਸੂਟ ਤਾਂ ਕਿਤੋਂ ਮਿਲਦਾ ਨਹੀਂ ਅਤੇ ਤੁਹਾਡੇ ਕੋਲ ਮਿਲਿਆ ਵਾ ਠੀਕ ਆ ਹੋਰ ਬਾਕੀ ਮੈਂ ਰੰਗ ਵੀ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਤੁਹਾਡੀ ਦੁਕਾਨ ਦਾ ਬਹੁਤ ਹੀ ਸੋਹਣਾ ਸੂਟ ਹੈ ਕਢਾਈ ਵੀ ਹੈ ਕਿਉਂਕਿ ਇਹ ਇੱਦਾਂ ਦਾ ਸੂਟ ਕਿਤੋਂ ਮਿਲਦਾ ਨੀ ਸ਼ੁਨੀਲ ਦਾ ਸੂਟ ਆ ਨਾ ਅਤੇ ਕਾਫ਼ੀ ਦੁਕਾਨ 'ਤੇ ਮੈਂ ਦੇਖਿਆ ਤੇ ਮੀਸ਼ੋ ਵਾਲੇ ਕੋਲ ਮਿਲਿਆ ਹੋਰ ਕਿਤੋਂ ਨਹੀਂ ਮਿਲਿਆ ਸੂਟ ਕਿਉਂਕਿ ਧੰਨਵਾਦ ਜੀ